ਮੈਂ ਫੇਸਬੁਕ ਟਵਿੱਟਰ ਅਤੇ ਇੰਸਟਾਗ੍ਰਾਮ ਵਰਗੇ ਸੋਸ਼ਲ ਮੀਡੀਆ ਦੀ ਵਰਤੋਂ ਆਪ ਕੀਤੀ ਹੈ ਇਸਦੀ ਵਰਤੋਂ ਮੈਂ ਦੂਜੇ ਲੋਕਾਂ ਨਾਲ ਬਾਤਚੀਤ ਕਰਨ ਲਈ ਅਤੇ ਸਮਾਜ ਵਿੱਚ ਕੀ ਚੱਲ ਰਿਹਾ ਉਹ ਜਾਣਨ ਲਈ ਵੀ ਕਰਦਾ ਹਾਂ ਇਸ ਤੋਂ ਇਲਾਵਾ ਇਹ ਨਿਰਲੇਖ ਹਾਸੇ ਦਾ ਸਰੋਤ ਵੀ ਨੇ ਇਸ ਉੱਤੇ ਕਾਫੀ ਹਾਸੇ ਵਾਲੀ ਵੀਡੀਓਜ ਆਉਂਦੀਆਂ ਨੇ ਅਤੇ ਉਹ ਵੇਖ ਕੇ ਮੇ ਮੇਰਾ ਮਨ ਵੀ ਕਾਫੀ ਵਧੀਆ ਰਹਿੰਦਾ ਹੈ ਅਤੇ ਕਾਫੀ ਸਟਰੈਸ ਮੇਰਾ ਦੂਰ ਹੋ ਜਾਂਦਾ ਹੈ ਇਸ ਤੋਂ ਇਲਾਵਾ ਇਹ ਸਿਰਫ ਹਾਸਾ ਹੀ ਨਹੀਂ ਇਹ ਇੱਕ ਤਰ੍ਹਾਂ ਦਾ ਨਿਊਜ਼ ਦਾ ਵੀ ਸਰੋਤ ਹੈ ਇਸ ਤੋਂ ਮੈਂ ਕਾਫੀ ਜਾਣਕਾਰੀ ਜਾਣ ਪਾਉਂਦਾ ਹਾਂ ਅਤੇ ਇਸ ਤੋਂ ਇਲਾਵਾ ਜੇ ਦੇਖਿਆ ਜਾਵੇ ਇਹਦੇ ਉੱਤੇ ਮੈਂ ਕਈ ਤਰ੍ਹਾਂ ਦੀ ਮਾਰਕੀਟਿੰਗ ਵੀ ਕੀਤੀ ਹੈ ਅਤੇ ਆਪਣਾ ਕੁਛ ਛੋਟਾ ਮੋਟਾ ਸਮਾਨ ਵੀ ਵੇਚਿਆ ਹੋਇਆ ਹੈ ਜੇ ਦੇਖਿਆ ਜਾਵੇ ਇਸ ਤ ਪਸੰਦੀਦਾ ਚੀਜ਼ਾਂ ਜੇ ਮੈਂ ਵੇਖਾਂ ਤਾਂ ਕਾਫੀ ਨੇ ਜਿੱਦਾਂ ਇਹ ਇਹਦਾ ਮੈਂ ਆਪਣੇ ਯਾਰਾਂ ਨਾਲ ਵੀਡੀਓ ਕੌਲ ਕਰ ਸਕਦਾ ਹਾਂ ਅਤੇ ਉਹਨਾਂ ਨਾਲ ਗੱਲ ਕਰ ਸਕਦਾ ਹਾਂ ਅਤੇ ਇਸ ਤੋਂ ਇਲਾਵਾ ਜੇ ਮੈਨੂੰ ਜੇ ਇਹ 'ਚ ਕੁਛ ਨਾ ਪਸੰਦ ਲੱਗਦਾ ਹੈ ਤਾਂ ਉਹ ਹੈ ਕਿ ਇਸ ਵਿੱਚ ਕਾਫੀ ਤਰ੍ਹਾਂ ਦੀ ਗਲਤ ਚੀਜ਼ਾਂ ਵੀ ਆਉਂਦੀਆਂ ਨੇ ਜੋ ਕਿ ਛੋਟੇ ਬੱਚਿਆਂ ਲਈ ਅਤੇ ਦੂਜਿਆਂ ਲਈ ਵਧੀਆ ਨਹੀਂ ਹੈ ਇਸ ਨਾਲ ਉਹਨਾਂ 'ਤੇ ਕਾਫੀ ਬੁਰਾ ਪ੍ਰਭਾਵ ਵੀ ਪੈਂਦਾ ਹੈ ਅਤੇ ਉਹ ਗਲਤ ਰਸਤੇ ਉੱਤੇ ਤੁਰਨਾ ਸ਼ੁਰੂ ਕਰ ਦਿੰਦੇ ਨੇ ਪਰ ਜੇ ਇਸਦਾ ਇਸਤੇਮਾਲ ਆਪਾਂ ਸੋਚ ਸਮਝ ਕੇ ਅਤੇ ਕਿਸੇ ਵੱਡੇ ਬੰਦੇ ਦੀ ਨਿਗਰਾਨੀ ਵਿੱਚ ਕਰੀਏ ਤਾਂ ਇਹ ਸੋਸ਼ਲ ਮੀਡੀਆ ਸਾਡੇ ਲਈ ਕਾਫੀ ਵਧੀਆ ਚੀਜ਼ ਹੋ ਸਕਦੀ ਹੈ ਇਸ ਨਾਲ ਸਾਨੂੰ ਕਾਫੀ ਕੁਛ ਜਾਣਨ ਨੂੰ ਮਿਲਦਾ ਹੈ ਅਤੇ ਆਪਾਂ ਸਮਾਜ ਦੇ ਬਾ ਬਾਰੇ ਵਧੀਆ ਜਾਣ ਸਕਦੇ ਹਾਂ ਅਤੇ ਆਪਣੇ ਸਮੇਂ ਦੇ ਨਾਲ ਨਾਲ ਉਹ ਕੀ ਸਮਾਜ 'ਚ ਹੋ ਰਿਹਾ ਉਹ ਵੀ ਸਾਨੂੰ ਪਤਾ ਲੱਗਦਾ ਰਹਿੰਦਾ ਹੈ ਇਸ ਲਈ ਮੈਂ ਇਹੀ ਕਹਾਂਗਾ ਸੋਸ਼ਲ ਮੀਡੀਆ ਦੀ ਜੇ ਵਰਤੋਂ ਕਰਨੀ ਹੈ ਤਾਂ ਤਾਂ ਵਧੀਆ ਤਰੀਕੇ ਨਾਲ ਕਰੋ ਕਿਉਂਕਿ ਇਸ ਨਾਲ ਕਾਫੀ ਕੁਛ ਵਧੀਆ ਸਿੱਖਣ ਨੂੰ ਮਿਲਦਾ ਹੈ